ਹੈਲੋ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਉਬਰ ਦੇ ਨਾਲ਼ ਇੱਕ ਵਿਜ਼ਿਟ ਆਪਣੀ ਪਾ ਫਾਈਨਲ ਕੀਤੀ ਸੀ ਜਿੱਥੇ ਮੈਂ ਖਾਲਸਾ ਕੋਲਜ ਦਾ ਰੱਖਿਆ ਸੀ ਖਾਲਸਾ ਕੋਲਜ ਜਾਣਾ ਸੀ ਸਰ ਤੁਹਾਡਾ ਜਿਹੜਾ ਡਰਾਈਵਰ ਹੈ ਨਾ ਮਨਿੰਦਰ ਸਿੰਘ ਉਹਨਾਂ ਦੇ ਨਾਲ਼ ਸੀ ਅਤੇ ਹੁਣ ਮੈਂ ਤੁਹਾਡੇ ਡਰਾਈਵਰ ਨੂੰ ਪੁੱਛ ਰਹੀ ਹਾਂ ਅਤੇ ਉਹ ਕਹਿੰਦਾ ਕਿ ਮੈਡਮ ਮੈਨੂੰ ਤਾਂ ਅਜੇ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਜਦਕਿ ਮੈਂ ਤਾਂ ਹੁਣ ਆਪਣੇ ਘਰ ਤੋਂ ਦਸ ਮਿੰਟ ਦੇ ਵਿੱਚ ਨਿਕਲਣਾ ਸੀ ਮੈਂ ਤੁਹਾਨੂੰ ਪੇਮੈਂਟ ਵੀ ਪੇਸ਼ਗੀ ਦੇ ਚੁੱਕੀ ਹਾਂ ਸਰ ਹਾਂ ਇਹ ਕੋਈ ਗੱਲ ਨਹੀਂ ਹੁੰਦੀ ਹੈਗੀ ਕੋਈ ਗੱਲ ਨਹੀਂ ਤੁਹਾਡਾ ਜੇ ਡਰਾਈਵਰ ਲੇਟ ਵੀ ਹੋ ਰਿਹਾ ਹੈ ਪਰ ਕਮ ਸੇ ਕਮ ਉਹਦਾ ਮੈਨੂੰ ਦੱਸਣਾ ਬਣਦਾ ਸੀ ਦਸ ਮਿੰਟ 'ਚ ਨਿਕਲਣਾ ਅਤੇ ਉਹ ਅੱਧਾ ਪੌਣਾ ਘੰਟਾ ਕਹਿ ਰਿਹਾ ਹਾਂ ਹੋ ਸਕਦਾ ਉਹ ਕਿਸੇ ਹੋਰ ਸਵਾਰੀ ਦੇ ਨਾਲ਼ ਲੇਟ ਹੋ ਗਿਆ ਹੋਵੇ ਬਟ ਮੇਰਾ ਉੱਥੇ ਸੈਮੀਨਾਰ ਹੈ ਸਰ ਮੈਂ ਲੇਟ ਹੋਣਾ ਨਹੀਂ ਸਰ ਮੈਂ ਮੈਂ ਉੱਥੇ ਲੇਟ ਨਹੀਂ ਪਹੁੰਚ ਸਕਦੀ ਠੀਕ ਹੈ ਤੁਸੀਂ ਸਮਝਦੇ ਹੋ ਨਾ ਕਿ ਜਿਹੜੇ ਵੱਡੇ ਕੰਮ ਹੁੰਦੇ ਨੇ ਅਸੀਂ ਉੱਥੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਮੈਂ ਇਸ ਲਈ ਹੁਣ ਫਿਰ ਉਹ ਵਾਲਾ ਜ ਜਿਹੜੀ ਤੁਹਾਡੇ ਦਿੱਤੀ ਸੀ ਪੇਸ਼ਗੀ ਉਹ ਵਾਪਸ ਲੈਣਾ ਚਾਹ ਰਹੀ ਹਾਂ ਅਤੇ ਤੁਹਾਡੇ ਨਾਲ਼ ਜਿਹੜੀ ਮੇਰੀ ਵਿਜ਼ਿਟ ਹੈਗੀ ਆ ਉਹਨੂੰ ਹੁਣ ਮੈਂ ਕੈਂਸਲ ਕਰਨਾ ਚਾਹ ਰਹੀ ਹਾਂ ਜਿਹੜੀ ਮੇਰੀ ਤੁਹਾਡੇ ਨਾਲ਼ ਸੀ ਜੇ ਤੁਸੀਂ ਦਸ ਮਿੰਟ ਦੇ ਵਿੱਚ ਕੋਈ ਹੋਰ ਡਰਾਈਵਰ ਭੇਜ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਤੁਸੀਂ ਜਿਹੜਾ ਮੈਂ ਤੁਹਾਨੂੰ ਪੇਸ਼ਗੀ ਦਿੱਤੀ ਹੈ ਉਹਨੂੰ ਰਿਫੰਡ ਕਰੋ ਅਤੇ ਨਾਲ਼ ਦੇ ਨਾਲ਼ ਆਪਣੇ ਸਾਰੇ ਡਰਾਈਵਰਾਂ ਨੂੰ ਇੱਕ ਹਿਦਾਇਤ ਵੀ ਕਰੋ ਕਿ ਜੇ ਤੁਸੀਂ ਕਿਸੇ ਤਰੀਕੇ ਲੇਟ ਹੋ ਰਹੇ ਹੋ ਤਾਂ ਕਮ ਸੇ ਕਮ ਆਪਣੀ ਅਗਲੀ ਸਵਾਰੀ ਨੂੰ ਇਨਫੋਰਮ ਕਰੋ ਉਹਨਾਂ ਨੂੰ ਦੱਸੋ ਤਾਂ ਕਿ ਵੇਲੇ ਸਿਰ ਉਹ ਕੋਈ ਹੋਰ ਆਪਣੀ ਕਾਰਵਾਈ ਕਰ ਸਕਣ ਇਹਦਾ ਕੋਈ ਮਤਲਬ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਵਾਰ ਵਾਰ ਪੁੱਛੀਏ ਅਤੇ ਤੁਸੀਂ ਅੱਗੇ ਤੋਂ ਇੰਝ ਕਰੀਏ ਹਾਂ ਨਹੀਂ ਨਹੀਂ ਸਰ ਇਹ ਗੱਲ ਤਾਂ ਮੈਂ ਤੁਹਾਡੀ ਹੁਣ ਸੁਣ ਹੀ ਨਹੀਂ ਸਕਦੀ ਹਾਂ ਠੀਕ ਆ ਪਰ ਇਹ ਹੈਗੀ ਹੈ ਮਿਹਰਬਾਨੀ